ਹੈਲੋ ਸਤਿ ਸ਼੍ਰੀ ਅਕਾਲ ਹਾਂਜੀ ਸਰ ਹਾਂਜੀ ਹਾਂਜੀ ਸਰ ਹਾਂਜੀ ਹਾਂਜੀ ਸਰ ਓਕੇ ਓਕੇ ਜੀ ਠੀਕ ਹੈ ਜੀ ਸਰ ਇਹਦੇ 'ਚ ਇਸ ਤਰ੍ਹਾਂ ਹੁੰਦਾ ਸਰ ਇੱਕ ਚੀਜ਼ ਆ ਜਾਂਦੀ ਇੱਕ ਆਪਾਂ ਵਾਲਪੇਪਰ ਲਗਵਾ ਸਕਦੇ ਹਾਂ ਵਾਲਪੇਪਰ 'ਚ ਵੀ ਥੋੜ੍ਹਾ ਬਜਟ 'ਚ ਆਜੂਗਾ ਇੱਕ ਹੁੰਦੀ ਪੀ ਬੀ ਸੀ ਪੀ ਬੀ ਸੀ ਜਿਹੜੀ ਹੁੰਦੀ ਆ ਵਾਲਪੇਪਰ ਨਾਲੋਂ ਥੋੜ੍ਹੀ ਕੋਸਟਲੀ ਹੁੰਦੀ ਆ ਉਹਦੇ ਵੱਖ ਵੱਖ ਡਿਜ਼ਾਇਨ ਜਿਹੇ ਹੁੰਦੇ ਆ ਉਹ ਤੁਸੀਂ ਆ ਸ਼ੋਰੂਮ 'ਚ ਆ ਕੇ ਸਲੈਕਟ ਕਰੋਗੇ ਉਹਦੇ 'ਚ ਅਲੱਗ ਅਲੱਗ ਤਰ੍ਹਾਂ ਦੀ ਕੁਆਲਿਟੀ ਹੁੰਦੀ ਹੈ ਉਹ ਤੁਸੀਂ ਆਪਣੇ ਬਜਟ ਦੇ ਅਕੋਰਡਿੰਗ ਦਾਸੋਗੇ ਦੱਸੋਗੇ ਉਹ ਯਾਨੀ ਕਿ ਸਕੇਅਰ ਫੁੱਟ ਦੇ ਹਿਸਾਬ ਨਾਲ ਉਹਦਾ ਖਰਚਾ ਹੁੰਦਾ ਗਾ ਅਤੇ ਵਾਲਪੇਪਰ ਜਿਹੜਾ ਵਾ ਉਹ ਪੀ ਬੀ ਸੀ ਨਾਲੋ ਥੋੜ੍ਹਾ ਜ਼ਿਆਦਾ ਸਸਤਾ ਪੈ ਜਾਂਦਾ ਵਾ ਉਹਦੇ ਨਾਲ ਤਾਂ ਯਾਨੀ ਕੇ ਮਕਾਨ ਦੀ ਲੁੱਕ ਬਹੁਤ ਅੱਛੀ ਬਣ ਜਾਂਦੀ ਹੈ ਬਾਕੀ ਉਹ ਤੁਹਾਡੇ ਬਜਟ 'ਤੇ ਡਿਪੈਂਡ ਕਰਦਾ ਤੁਸੀਂ ਕੀ ਕਰਵਾਉਣਾ ਉਸ ਅਕੋਰਡਿੰਗ ਤੁਹਾਨੂੰ ਅਸੀਂ ਦੱਸ ਸਕਦੇ ਹਾਂਜੀ ਹਾਂਜੀ ਉਹਦੇ 'ਚ ਜੀ ਵਾਲਪੇਪਰ ਦਾ ਜ਼ਿਆਦਾ ਫ਼ਾਇਦਾ ਹੋਊਗਾ ਤੁਹਾਨੂੰ ਪੀ ਬੀ ਸੀ ਜਿਹੜੀ ਸਲਾਬ ਨਾਲ ਥੋੜ੍ਹੀ ਜਿਹੀ ਖਰਾਬ ਹੋਣ ਦੇ ਚਾਂਸਿਸ ਹੁੰਦੇ ਆ ਅਤੇ ਜਿਹੜਾ ਵਾਲਪੇਪਰ ਹੁੰਦਾ ਉਹਨੂੰ ਕੋਈ ਨੁਕਸਾਨ ਨਹੀਂ ਹੁੰਦਾ ਗਾ ਤਾਂ ਵਾਲਪੇਪਰ ਤੁਹਾਨੂੰ ਜ਼ਿਆਦਾ ਵੈਟਰ ਵਧੀਆ ਆਪਸ਼ਨ ਹੈ

ਕੋਸਟ ਜੀ ਤਕਰੀਬਨ ਬਾਰਾਂ ਰੁਪਏ ਸਕੈਰ ਫੁੱਟ ਚੱਲਦਾ ਗਾ ਅਤੇ ਜੇ ਤੁਸੀਂ ਸ ਪੂਰਾ ਦੇ ਹਾਊਸ ਦਾ ਕਰਵਾਉਗੇ ਤਾਂ ਉਹਦੇ 'ਚ ਆਪਾਂ ਕੁਛ ਡਿਸਕਾਊਂਟ ਵੀ ਕਰ ਦਾਂਗੇ ਤੁਹਾਨੂੰ ਹਾਂਜੀ ਵਾਲਪੇਪਰ 'ਚ ਇਸ ਤਰ੍ਹਾਂ ਹੁੰਦਾ ਜੀ ਹੁਣ ਮਾਰਕੀਟ 'ਚ ਕਈ ਤਰ੍ਹਾਂ ਦੇ ਵਾਲਪੇਪਰ ਕਹਿ ਕੇ ਵਾਲਪੇਪਰ ਅਤੇ ਫਲੈਕਸ ਲਗਾ ਦਿੰਦੇ ਆ ਜਿਹੜਾ ਫਲੈਕਸ ਹੈ ਉਹ ਛੇ ਕੁ ਮਹੀਨੇ ਬਾਅਦ ਖਰਾਬ ਹੁੰਦਾ ਜਿਹੜਾ ਵਾਲਪੇਪਰ ਹੁੰਦਾ ਵਾ ਉਹ ਪ੍ਰੋਪਰ ਤਕਰੀਬਨ ਉਹਦੀ ਘੱਟੋ ਘੱਟ ਪੰਜ ਸਾਲ ਦੀ ਗਰੰਟੀ ਅਸੀਂ ਦੇਵਾਂਗੇ ਤੁਹਾਨੂੰ ਪੰਜ ਸਾਲ ਤੱਕ ਤੁਹਾਡਾ ਬਿਲਕੁਲ ਕੋਈ ਕੰਪਲੇਂਟ ਹੋਈ ਉਹ ਸਾਡੀ ਰਿਸਪੋਂਸੀਬਿਲਟੀ ਹੋਊਗੀ ਅਸੀਂ ਉਹਨੂੰ ਪੂਰਾ ਚੇੇਂਗ ਕਰਕੇ ਦੇਵਾਂਗੇ ਜਿਹੜੇ ਮਾਰਕੀਟ 'ਚ ਕਹਿ ਕੇ ਵਾਲਪੇਪਰ ਉਹ ਫਲੈਕਸ ਬੋਰਡ ਲਾਦੇ ਫਲੈਕਸ ਬੋਰਡ ਛੇਤੀ ਖਰਾਬ ਹੋ ਜਾਂਦੇ ਆ ਅਤੇ ਕੋਸਟ ਤੁਹਾਨੂੰ ਉਹ ਵਾਲਪੇਪਰ ਦੀ ਹੀ ਲਾਉਣਗੇ ਇਕ ਗੱਲ 'ਚ ਸਾਡੀ ਗਾਰੰਟੀ ਹੋਊਗੀ ਅਸੀਂ ਤੁਹਾਨੂੰ ਫਲੈਕਸ ਨਹੀਂ ਵਾਲਪੇਪਰ ਹੀ ਲਗਾ ਕੇ ਦੇਵਾਂਗੇ ਓਕੇ ਸਰ ਥੈਂਕ ਯੂ ਜੀ ਥੈਂਕ ਯੂ ਸਰ ਥੈਂਕ ਯੂ ਫ਼ੋਰ ਕਾਲਿੰਗ ਸਰ